ਮੀਡੀਆ ਵਿੱਚ ਦਿਖਾਏ ਜਾਣ ਵਾਲੇ ਜਿਹੜੇ ਇਸ਼ਤਿਹਾਰ ਹਨ ਉਹ ਲੋਕਾਂ ਨੂੰ ਭਟਕਣਾ ਵਾਲੇ ਸਾਈਡ 'ਤੇ ਲੈ ਕੇ ਜਾਂਦੇ ਆ ਜਿਵੇਂ ਕਿ ਆਪਾਂ ਐਡਸ ਆਪਾਂ ਐਡਸ 'ਚ ਦੇਖਦੇ ਹਾਂ ਕੀ ਹੁੰਦਾ ਕਿ ਜਿਹੜੀ ਕੋਈ ਵੀ ਚੀਜ਼ ਹੈ ਹੈ ਨਾ ਇਹ ਆਪਾਂ ਕਿਸੇ ਸਾਬਣ ਦੀ ਫੇਸਵਾਸ਼ ਦੀ ਜੇ ਆਪਾਂ ਉਦਾਹਰਨਾਂ ਲਈਏ ਤਾਂ ਉਹ ਬਹੁਤ ਚਮਕੀਲੀ ਧਮਕੀਲੀ ਦਿਖਾਈ ਹੁੰਦੀ ਹੈ ਅਤੇ ਦਾਅਵੇ ਇੱਦਾਂ ਦੇ ਕੀਤੇ ਜਾਂਦੇ ਹੁੰਦੇ ਹੈ ਕਿ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਵੀ ਹਾਂ ਇਹ ਸਾਬਣ ਆ ਇਹ ਫੇਸਵਾਸ਼ ਲਾਉਣ ਨਾਲ ਇੱਕ ਦਿਨ 'ਚ ਤੁਹਾਡਾ ਚਿਹਰਾ ਨਿੱਖਰ ਜਾਵੇਗਾ ਜਾਂ ਕਰੀਮਾਂ ਵੀ ਤੁਹਾਨੂੰ ਕਾਲੇ ਤੋਂ ਗੋਰਾ ਕਰ ਦੇਣਗੀਆਂ ਜੇ ਆਪਾਂ ਅ ਦੇਖੀਏ ਤਾਂ ਸਾਇੰਟੀਫਿਕਲੀ ਜਾਂ ਲੋਜੀਕਲੀ ਇੱਦਾਂ ਨਹੀਂ ਹੁੰਦਾ ਹੈਗਾ ਅਤੇ ਬਟ ਉਹ ਇਸ਼ਤਿਹਾਰਾਂ 'ਚ ਦਾਅਵਾ ਕੀਤਾ ਗਿਆ ਹੁੰਦਾ ਅਤੇ ਜੋ ਕਿ ਗਲਤ ਚੀਜ਼ ਹੈ ਇਹ ਤਾਂ ਆਮ ਇਨਸਾਨ ਨੂੰ ਜਾਂ ਆਮ ਲੋਕਾਂ ਨੂੰ ਇੱਕ ਭਟਕਣਾ ਜਾਂ ਗਲਤ ਰਾਹ 'ਤੇ ਜਾਂ ਉਹਨਾਂ ਨੂੰ ਓਹਲੇ 'ਚ ਰੱਖਣਾ ਵਾਲੀ ਗੱਲ ਹੋ ਗਈ ਤਾਂ ਕਰਕੇ ਮੇਰੇ ਹਿਸਾਬ ਨਾਲ ਮੀਡੀਆ ਜੋ ਕਿ ਹੈ ਆਪਣੇ ਇਸ਼ਤਿਹਾਰਾਂ ਦੇ ਥਰੂ ਜਾਂ ਇਸ਼ਤਿਹਾਰ ਜੋ ਮੀਡੀਆ ਦੇ ਥਰੂ ਦਿਖਾਏ ਜਾਂਦੇ ਹਨ ਉਹ ਇੱਕ ਗਲਤ ਹਨ ਅਤੇ ਉਹ ਗਲਤ ਦਾਅਵੇ ਕਰਦੇ ਆ ਉਹਨਾਂ ਦੇ ਦਾਅਵੇ ਕਰਨਾ ਗਲਤ ਹੈ ਸਹੀ ਦਾਅਵੇ ਕਰਨ ਜੋ ਚੀਜ਼ ਐਚੁਅਲ ਹੈ ਸਹੀ ਹੈ ਉਹ ਚੀਜ਼ ਦੱਸਣ ਤਾਂ ਇਹ ਇਸ਼ਤਿਹਾਰ ਸਹੀ ਨੇ ਅਦਰਵਾਈਜ਼ ਨਹੀਂ